ਸਾਡੇ ਪੰਜਾਬ ਦੇ ਵਿੱਚ ਚੁਣੇ ਗਏ ਮੁੱਖ ਮੰਤਰੀ ਦਾ ਬਹੁਤ ਹੀ ਵੱਡਾ ਅਹੁਦਾ ਮੰਨਿਆ ਜਾਂਦਾ ਮੁੱਖ ਮੰਤਰੀ ਬਹੁਤ ਹੀ ਵਧੀਆ ਜੋ ਅੱਜ ਕੱਲ੍ਹ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਿਹਾ ਉਹ ਹੋਰ ਇੱਕ ਮੁਹੱਲਾ ਕਲੀਨਿਕ ਬਣਾ ਰਿਹਾ ਹੈ ਉਹ ਹੋਰ ਵੀ ਬਹੁਤ ਜ਼ਿਆਦਾ ਕੁਛ ਵਧੀਆ ਹੀ ਕੰਮ ਕਰ ਰਿਹਾ ਹੈ ਉਹਨੇ ਜਾਤ ਪਾਤ ਦਾ ਖਤਮ ਕੀਤਾ ਉਹ ਇੱਕ ਆਮ ਆਦਮੀ ਤੋਂ ਉੱਠ ਕੇ ਇੱਕ ਬਹੁਤ ਵਧੀਆ ਹੀ ਸਰਕਾਰ ਬਣਾਈ ਹੋਈ ਹੈ ਸਾਡੇ ਮੁੱਖ ਮੰਤਰੀ ਦਾ ਇੱਕ ਅਲੱਗ ਹੀ ਰੁਤਬਾ ਹੈ ਉਹ ਕਿਸੇ ਨੂੰ ਕੋਈ ਖ਼ਾਸ ਨਹੀਂ ਸਮਝਦਾ ਉਹ ਸਭ ਨੂੰ ਇੱਕ ਬਰਾਬਰ ਹੀ ਸਮਝਦਾ ਉਹਦੇ ਲਈ ਕੋਈ ਵੱਡਾ ਛੋਟਾ ਬੰਦਾ ਨਹੀਂ ਹੈਗਾ ਮੁੱਖ ਮੰਤਰੀ ਦੇ ਅਹੀ ਆਪਣਾ ਹੀ ਇੱਕ ਰੁਤਬਾ ਹੈ ਉਹ ਬਹੁਤ ਵਧੀਆ ਮੁੱਖ ਮੰਤਰੀ ਹੈ ਪੰਜਾਬ ਲਈ ਉਹਨੇ ਕਿੰਨਾ ਕੁਛ ਹੀ ਕਰ ਦਿੱਤਾ ਪੰਜਾਬ ਦੀ ਵਧੀਆ ਤਕਨੀਕ ਬਣਾ ਰਿਹਾ ਉਹ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਮੁੱਖ ਮੰਤਰੀ ਦੇ ਪੰਜਾਬ ਮੁੱਖ ਮੰਤਰੀ ਦਾ ਪੰਜਾਬ ਦਾ ਇੱਕ ਪੰਜਾਬ ਨੂੰ ਬਹੁਤ ਸੋਹਣਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਪੰਜਾਬ ਵਿੱਚ ਕਈ ਤਰ੍ਹਾਂ ਦੇ ਉਦਯੋਗ ਨਵੇਂ ਲਗਾਉਣ ਦੀ ਕੋਸ਼ਿਸ਼ਾਂ ਪੰਜਾਬ ਦੇ ਨੌਜਵਾਨਾਂ ਲਈ ਨੌਕਰੀਆਂ ਦੇ ਰਿਹਾ ਹੈ ਪੰਜਾਬ ਦਾ ਮੁੱਖ ਮੰਤਰੀ ਇੱਕ ਸੁਲਝਿਆ ਹੋਇਆ ਇਨਸਾਨ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਜਿੰਨਾ ਹੀ ਕਹਿ ਲਓ ਉੰਨਾ ਹੀ ਥੋੜ੍ਹਾ ਹੈ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਵਾਸਤੇ ਬਹੁਤ ਕੁਛ ਕਰ ਰਿਹਾ ਉਹ ਪੰਜਾਬ ਲਈ ਬਹੁਤ ਸੋਹਣਾ ਪੰਜਾਬ ਬਣਾ ਰਿਹਾ ਉਹ ਪੰਜਾਬ ਦੇ ਨੌਜ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਿਹਾ ਉਹ ਪੰਜਾਬ ਦੇ ਵਿੱਚ ਨਸ਼ਾ ਮੁਕਤ ਪੰਜਾਬ ਬਣਾ ਰਿਹਾ ਪੰਜਾਬ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇ ਰਿਹਾ ਹੈ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਵਿੱਚ ਨਵੀਂ ਤਰੱਕੀ ਦੀ ਲਹਿਰ ਲਿਆਉਣਾ ਚਾਹੁੰਦਾ ਹੈ ਉਹ ਕਹਿੰਦਾ ਹੈ ਪੰਜਾਬ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਨੌਜਵਾਨਾਂ ਲਈ ਕਈ ਤਰ੍ਹਾਂ ਦੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਤਰ੍ਹਾਂ ਦੀਆਂ ਹੀ ਸੇ ਸੇਵਾਵਾਂ ਦਿੱਤੀਆਂ ਹੋਈਆ ਉਹ ਆਮ ਪਬਲਿਕ ਲਈ ਬਹੁਤ ਕੁਛ ਕਰ ਰਿਹਾ ਹੈ ਧੰਨਵਾਦ